ਜੀ ਹਾਂ ਮੈਂ ਚਿੱਤਰਕਾਰੀ ਦੀਆਂ ਕਲਾਸਾਂ ਲਵਾਈਆਂ ਸਨ ਅਤੇ ਮੈਂ ਪੰਜਵੀਂ ਕਲਾਸ ਵਿੱਚ ਸੀ ਜਦੋਂ ਕਿ ਮੈਨੂੰ ਇੱਕ ਚਿੱਤਰਕਾਰੀ ਮੁਕਾਬਲੇ ਵਿੱਚ ਲਾਇਆ ਗਿਆ ਸੀ ਕਿਤੇ ਉਦੋਂ ਮੈਂ ਇੱਕ ਡਰਾਇੰਗ ਬਣਾਈ ਸੀਗੀ ਅਤੇ ਜੋ ਕਿ ਵੈਸੇ ਮੇਰੀ ਵਧੀਆ ਸੀ ਪਰ ਮੈਨੂੰ ਥੋੜ੍ਹੀਆਂ ਜਿਹੀਆਂ ਉਹਦੇ ਵਿੱਚ ਗਲਤੀਆਂ ਲੱਗੀਆਂ ਸੀਗੀਆਂ ਅਤੇ ਮੈਨੂੰ ਮੈਨੂੰ ਮਾਣ ਸੀ ਕਿ ਮੈਂ ਹੋਰ ਵੀ ਜ਼ਿਆਦਾ ਵਧੀਆ ਕਰ ਸਕਦੀ ਹਾਂ ਜੇ ਕਰਨ ਲੱਗਾ ਤਾਂ ਫਿਰ ਮੈਂ ਹੌਲੀ ਹੌਲੀ ਇੱਕ ਵਰਕਸ਼ੋਪ 'ਤੇ ਲੱਗੀ ਸਾਡੇ ਨੇੜੇ ਹੀ ਸ਼ਹਿਰ ਵਿੱਚ ਵੜਕਸ਼ੋਪ ਸੀਗੀ ਫਿਰ ਮੈਂ ਘਰਦਿਆਂ ਨੂੰ ਪੁੱਛਿਆ ਤਾਂ ਫਿਰ ਮੈਂ ਉੱਥੇ ਲੱਗੀ ਵਰਕਸ਼ੋਪ ਉੱਪਰ ਅਤੇ ਵਰਕਸ਼ੋਪ 'ਤੇ ਲੱਗ ਕੇ ਮੈਂ ਹੋਰ ਵੀ ਮੈਂ ਫਿਰ ਗਰੈਂਡ ਬਣਾਉਣੀ ਸ਼ੁਰੂ ਕੀਤੀ ਅਤੇ ਮੇਰੀ ਡਰੈਂਗ ਹੋਰ ਵੀ ਜ਼ਿਆਦਾ ਸੁਧਰ ਗਈ ਸੀ ਅਤੇ ਤਾਂ ਮੈਂ ਹੌਲੀ ਹੌਲੀ ਡਰੈਂਗ ਵਿੱਚ ਟਾਈਮ ਦਈ ਗਈ ਦਈ ਗਈ ਮਤਲਬ ਕਿ ਦੋ ਤਿੰਨ ਘੰਟੇ ਵਰਕਸ਼ਾਪ 'ਤੇ ਵੀ ਲਾਉਂਦੀ ਸੀ ਅਤੇ ਘਰ ਆ ਕੇ ਵੀ ਦੋ ਤਿੰਨ ਘੰਟੇ ਲਾਉਂਦੀ ਸੀ ਅਤੇ ਮੇਰੀ ਡਰੈਂਗ ਹੋਰ ਵੀ ਜ਼ਿਆਦਾ ਸੁਧਰ ਗਈ ਸੀ ਅਤੇ ਹੌਲੀ ਹੌਲੀ ਇਹ ਸਧਾਰਨ ਕਾਰਨ ਮੈਂ ਫਿਰ ਜਦੋਂ ਚਿੱਤਰਕਾਰੀ ਦੇ ਵਿੱਚ ਜਾਂਦੀ ਸੀ ਤਾਂ ਮੇਰੀ ਡਰੈਂਡ ਸੋਹਣੀ ਲੱਗਦੀ ਸੀ ਅਤੇ ਮੈਂ ਤਾਂ ਕਰਕੇ ਇਹ ਚਿੱਤਰਕਾਰ ਦੀਆਂ ਕਲਾਸਾਂ ਲਵਾਈਆਂ ਸਨ ਅਤੇ ਕਲਾਸ ਅਤੇ ਮੇਰੀ ਡਰੈਂਗ ਹੋਰ ਵੀ ਜ਼ਿਆਦਾ ਸੋਹਣੀ ਹੋ ਗਈ ਸੀ ਕਿਉਂਕਿ ਉਦੋਂ ਮੈਂ ਪਹਿਲੀ ਕੀਤੀ ਸੀ ਜਦੋਂ ਕਿ ਪੰਜਵੀਂ ਕਲਾਸ 'ਚ ਸੀਗੀ ਉਦੋਂ ਪਹਿਲੀ ਹੀ ਕੀਤੀ ਸੀ ਅਤੇ ਉਦੋਂ ਵੀ ਹੋਈ ਤਾਂ ਸੋਹਣੀ ਸੀ ਪਰ ਮੈਨੂੰ ਇੰਨਾ ਨਹੀਂ ਪਤਾ ਸੀ ਅਤੇ ਹੌਲੀ ਹੌਲੀ ਮੈਂ ਫਿਰ ਵਰਕਸ਼ੋਪ 'ਤੇ ਵੀ ਲੱਗੀ ਉੱਥੋਂ ਸੋਹਣੀ ਹੋ ਗਈ ਅਤੇ ਕੁਛ ਜੇ ਨਹੀਂ ਕੁਛ ਪਤਾ ਲੱਗਦਾ ਸੀਗਾ ਤਾਂ ਯੂਟੀਊਬ 'ਤੇ ਵੀ ਹੀ ਕਰ ਲੈਂਦੀ ਸੀ ਇਸ ਲਈ ਮੈਨੂੰ ਹੋਰ ਵੀ ਜ਼ਿਆਦਾ ਮੇਰੇ 'ਤੇ ਮਾਣ ਹੋ ਗਿਆ ਸੀ ਅਤੇ ਹੋਰ ਵੀ ਜ਼ਿਆਦਾ ਸੋਹਣੀ ਹੋ ਸਕਦੀ ਹੈ ਅਤੇ ਹੌਲੀ ਹੌਲੀ ਹੁੰਦੀ ਜਾ ਰਹੀ